ਯੋਗਾ ਇੱਕ ਪੁਰਾਣਿਕ ਵਿਧੀਆਂ ਨਾਲ ਸਰੀਰ ਨੂੰ ਤੰਦਰੁਸਤ ਰੱਖਣ ਦਾ ਇੱਕ ਵਿਗਿਆਨਿਕ ਸਾਧਨ ਹੈ ਇਸ ਨਾਲ ਸਰੀਰਕ ਦੇ ਨਾਲ ਨਾਲ ਮਾਨਸਿਕ ਅਤੇ ਮਜ਼ਬੂਤੀ ਵੀ ਆਉਂਦੀ ਹੈ ਯੋਗਾ ਕਰਨ ਤੋਂ ਪਹਿਲਾਂ ਜਿਵੇਂ ਕਿ ਸਰੀਰਕ ਅਤੇ ਮਾਨਸਿਕ ਨੀਰਸਤਾ ਛਾਈ ਹੁੰਦੀ ਹੈ ਇਸ ਨੂੰ ਕਰਨ ਤੋਂ ਬਾਅਦ ਤਨ ਅਤੇ ਮਨ ਵਿੱਚ ਪ੍ਰਫੁੱਲਤਾ ਮਹਿਸੂਸ ਹੁੰਦੀ ਹੈ ਯੋਗਾ ਕਰਨ ਨਾਲ ਹੱਡੀਆਂ ਨੂੰ ਮਜ਼ਬੂਤੀ ਮਿਲਦੀ ਹੈ ਪੇਟ ਦੇ ਰੋਗ ਠੀਕ ਹੁੰਦੇ ਹਨ ਅੱਖਾਂ ਦੀ ਰੋਸ਼ਨੀ ਵਧਦੀ ਹੈ ਅਤੇ ਦਿਮਾਗ ਸ਼ਾਂਤ ਰਹਿੰਦਾ ਹੈ ਅਤੇ ਸਾਡੀ ਸੋਚ ਸ਼ਕਤੀ ਵਧਦੀ ਹੈ ਇਸ ਨਾਲ ਰੀੜ੍ਹ ਦੀ ਹੱਡੀ ਨਾਲ ਜੁੜੀਆਂ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ ਜੋ ਕਿ ਅੱਜ ਕੱਲ੍ਹ ਦੀ ਆਮ ਬਿਮਾਰੀ ਹੈ ਅਤੇ ਇਸ ਨਾਲ ਸਰੀਰਕ ਲਚਕਤਾ ਵਿੱਚ ਵਾਧਾ ਹੁੰਦਾ ਹੈ ਯੋਗਾ ਨੂੰ ਸਵੇਰ ਦੇ ਵਕਤ ਸੂਰਜ ਉੱਗਣ ਤੋਂ ਪਹਿਲਾਂ ਕਰਨਾ ਸਰੀਰ ਨੂੰ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਕਰਦਾ ਹੈ ਇਸ ਨੂੰ ਕਰਨ ਤੋਂ ਬਾਅਦ ਸਹੀ ਤਰੀਕੇ ਨਾਲ ਭੁੱਖ ਲੱਗਦੀ ਹੈ ਅਤੇ ਪਾਚਣ ਕਿਰਿਆ ਵਿੱਚ ਵਾਧਾ ਹੁੰਦਾ ਹੈ ਅਤੇ ਸਰੀਰ ਵਿੱਚ ਕੰਮ ਕਾਰ ਵਿੱਚ ਸਫੁਰਤੀ ਬਣੀ ਰਹਿੰਦੀ ਹੈ ਯੋਗਾ ਨੂੰ ਰੋਜ਼ਾਨਾ ਕਰਨ ਨਾਲ ਅੱਜ ਕੱਲ੍ਹ ਹੋਣ ਵਾਲੀਆਂ ਆਮ ਬਿਮਾਰੀਆਂ ਜਿਵੇਂ ਕਿ ਸ਼ੂਗਰ ਕੈਂਸਰ ਅਤੇ ਆਮ ਤੌਰ 'ਤੇ ਹੋਣ ਵਾਲੀਆਂ ਜਨਾਨਾਂ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ